ਸਾਡੇ ਇਲਾਕੇ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਅਤੇ ਲੋਕ ਖੇਤੀ ਦਾ ਧੰਦਾ ਕਰਦੇ ਹਨ ਅਤੇ ਮੱਛੀਆਂ ਫੜ੍ਹਨ ਵਗੈਰਾ ਦਾ ਧੰਦਾ ਸਾਡੇ ਇਲਾਕੇ ਵਿੱਚ ਨਹੀਂ ਹੁੰਦਾ ਅਤੇ ਨਾ ਹੀ ਕੋਈ ਸਾਡੇ ਇਲਾਕੇ ਦੇ ਵਿੱਚ ਮੱਛੀਆਂ ਫੜ੍ਹਦਾ ਏ ਅਤੇ ਨਾ ਹੀ ਕੋਈ ਮਛੇਰਾ ਪਾਇਆ ਜਾਂਦਾ ਹੈ ਅਤੇ ਇਸ ਕਰਕੇ ਸਾਨੂੰ ਇਸ ਸੰਬੰਧੀ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੈ